ਮੇਰਾ ਮਨਪਸੰਦ ਫਰੂਟ ਹੈਗਾ ਸੇਬ ਚੀਕੂ ਅਤੇ ਅਨਾਰ ਠੀਕ ਹੈ ਜੀ ਅਤੇ ਫਾਸਟ ਫੂਡ 'ਚ ਹੈਗਾ ਚਾਂਪ ਚਾਂਪ ਹੋ ਗਈ ਜੀ ਨਿਊਡਲ ਹੋ ਗਏ ਬਰਗਰ ਅਤੇ ਆਪਣਾ ਪੀਣ ਵਾਲੀ ਚੀਜ਼ਾਂ ਕੋਕ ਲਿਮਕਾ